ਸਾਡੇ ਪਿੰਡ ਵਿੱਚ ਸਰਕਾਰੀ ਕਲੀਨਿਕ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਦੂਰ ਸ਼ਹਿਰ ਜਾ ਕੇ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਐਮਰਜੈਂਸੀ ਵਿੱਚ ਲੋਕ ਇਲਾਜ ਨਾ ਕਰਵਾਉਣ ਵਿੱਚੋਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਪਿੰਡ ਵਿੱਚ ਆਵਾਜਾਈ ਦੀ ਦੀ ਬਹੁਤ ਸਮੱਸਿਆ ਹੈ ਸਰਕਾਰ ਤੋਂ ਆਹੀ ਉਮੀਦ ਕਰਦੇ ਹਾਂ ਕਿ ਉਹ ਸੜਕਾਂ ਚੰਗੀਆਂ ਬਣਾਉਣ ਅਤੇ ਸੜਕਾਂ ਦਾ ਇਹੋ ਜਿਹਾ ਸਿਸਟਮ ਬਣਾਉਣ ਕਿ ਤਾਂ ਜੋ ਵੱਡੇ ਵਹੀਕਲ ਵੀ ਪਿੰਡ ਤੋਂ ਬਾਹਰ ਅਤੇ ਪਿੰਡ ਵਿੱਚ ਆਸਾਨੀ ਨਾਲ ਲਿਆ ਜਾ ਸਕਣ ਸਿੱਖਿਆ ਲਈ ਵੀ ਸਾਡੇ ਪਿੰਡ ਵਿੱਚ ਸਕੂਲ ਹੋਣਾ ਚਾਹੀਦਾ ਹੈ ਸਕੂਲ ਨਾ ਹੋਣ ਕਰਕੇ ਪਿੰਡ ਦੇ ਬੱਚਿਆਂ ਨੂੰ ਸ਼ਹਿਰ ਜਾ ਕੇ ਪੜ੍ਹਾਈ ਕਰਨੀ ਪੈਂਦੀ ਹੈ ਕਈ ਬੱਚੇ ਸ਼ਹਿਰ ਨਾ ਜਾ ਸਕਣ ਕਾਰਨ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਸਰਕਾਰ ਤੋਂ ਆਹੀ ਉਮੀਦ ਹੈ ਕਿ ਸਰਕਾਰ ਵੀ ਆਪਣਾ ਯੋਗਦਾਨ ਇਹਨਾਂ ਸਭ ਚੀਜ਼ਾਂ ਉੱਤੇ ਪਾਉਣ ਤਾਂ ਜੋ ਪਿੰਡ ਦਾ ਵਿਕਾਸ ਸਹੀ ਢੰਗ ਸਹੀ ਤਰੀਕੇ ਨਾਲ ਹੋ ਸਕੇ